ਜੇਕਰ ਬੌਧਿਕ ਅਤੇ ਇਤਿਹਾਸਿਕ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਪੰਜਾਬ ਦਾ ਭਾਰਤ ਵਿੱਚ ਇੱਕ ਅਲੱਗ ਹੀ ਸਥਾਨ ਹੈ ਪੰਜਾਬ ਇੱਕ ਬਹੁਤ ਹੀ ਇਤਿਹਾਸਿਕ ਰਾਜ ਹੈ ਅਤੇ ਇਸ ਦਾ ਇਤਿਹਾਸ ਵੀ ਬਹੁਤ ਹੀ ਵਿਰਲਾ ਹੈ ਜੇਕਰ ਇਹਦੇ ਬੌਧਿਕ ਵਿਸ਼ੇਸ਼ ਵਿਸ਼ੇਸ਼ਤਾਵਾਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਹਦੇ ਹਿਮਾਚਲ ਸਾਈਡ ਹਿਮਾਚਲ ਸਾਈਡ ਇਹ ਇਹ ਸ਼ਿਵਾਲਿਕ ਦੀ ਸ਼ਿਵਾਲਿਕ ਦੇ ਪੈਰਾਂ ਵਿੱਚ ਵਸਿਆ ਹੋਇਆ ਹੈ ਅਤੇ ਇਹਦੇ ਦਕਸ਼ਿਣ ਸਾਈਡ ਰਾਜਸਥਾਨ ਰਾਜਸਥਾਨ ਦੀ ਮਾਰੂਥਲ ਵਾਲੀ ਭੂਮੀ ਹੈ ਇਹਦੇ ਪੱਛਚਿਮ ਸਾਈਡ ਪੱਛਮ ਸਾਈਡ ਇਹਦੇ ਪਾਕਿਸਤਾਨ ਪਾਕਿਸਤਾਨ ਲੱਗਦਾ ਹੈ ਅਤੇ ਇਹਦੇ ਉੱਤਰ ਸਾਈਡ ਹਿਮ ਹਿਮਾਚਲ ਅਤੇ ਹਰਿਆਣਾ ਹਰਿਆਣਾ ਨਾਮ ਦੇ ਦੋ ਰਾਜਯ ਰਾਜ ਲੱਗਦੇ ਹਨ ਪੰਜਾ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਪਹਾੜ ਵੀ ਹਨ ਨਦੀਆਂ ਵੀ ਹਨ ਅਤੇ ਇੱਥੇ ਦੀ ਧਰਤੀ ਬਹੁਤ ਹੀ ਉਪਜਾਊ ਮੰਨੀ ਗਈ ਹੈ ਪਹਾੜ ਦੀ ਗੱਲ ਕਰੀਏ ਤਾਂ ਹਿਮਾਚਲ ਸਾਈਡ ਸ਼ਿਵਾਲਿਕ ਦੀ ਪਹਾੜੀ ਇਸਨੂੰ ਲੱਗਦੀਆਂ ਹਨ ਅਤੇ ਜੰਮੂ ਕਸ਼ਮੀਰ ਦੀ ਸਾਈਡ ਵੀ ਇਸ ਨੂੰ ਪਹਾੜ ਲੱਗਦੇ ਹਨ ਨਦੀਆਂ ਦੀ ਗੱਲ ਕਰੀਏ ਤਾਂ ਇਸਦਾ ਨਾਮ ਹੀ ਨਦੀਆਂ ਉੱਤੇ ਪਿਆ ਪੰਜਾਬ ਪੰਜਾਬ ਦਾ ਮਤਲਬ ਹੈ ਪੰਜ ਨਦੀਆਂ ਦੀ ਭੂਮੀ ਜਿਸਦੇ ਵਿੱਚ ਕਿ ਰਾਵੀ ਸਤਲੁਜ ਬਿਆਸ ਜੇਹਲਮ ਚਨਾਬ ਆ ਆਦਿ ਨਦੀਆਂ ਹਨ ਹਾਲਾਂਕਿ ਹੁਣ ਪੰਜਾਬ ਵਿੱਚ ਤਿੰਨ ਨਦੀਆਂ ਹੀ ਰਹਿ ਗਈਆਂ ਹਨ ਦੋ ਨਦੀਆਂ ਜੇਹਲਮ ਅਤੇ ਚਨਾਬ ਪਾਕਿਸਤਾਨ ਵਿੱਚ ਚਲੀ ਗਈਆਂ ਹਨ ਰਾਵੀ ਬਿਆਸ ਅਤੇ ਸਤਲੁਜ ਦੀ ਨ ਸਤਲੁਜ ਨਦੀਆਂ ਹੀ ਇਸ ਨੂੰ ਉਪਜਾਊ ਬਣਾਉਂਦੀਆਂ ਹਨ ਜਦੋਂ ਇਹਨਾਂ ਨਦੀਆਂ ਵਿੱਚ ਬਾੜ ਆਉਂਦੀ ਹੈ ਤਾਂ ਇਹ ਆਪਣੇ ਨਾਲ ਬਹੁਤ ਹੀ ਉਪਜਾਊ ਖਣਿਜ ਵਗੈਰਾ ਲੇਕਰ ਆਉਂਦੀਆਂ ਹਨ ਜਿਸ ਜਿਸ ਨਾਲ ਕਿ ਸਥਿ ਇੱਥੇ ਦੀ ਧਰਤੀ ਬਹੁਤ ਹੀ ਉਪਜਾਊ ਬਣ ਗਈ ਹੈ ਜ ਇਸ ਇਸ ਕਰਕੇ ਹੀ ਇੱਥੇ ਹਰ ਪ੍ਰਕਾਰ ਦੀ ਫਸਲ ਉ ਉਗਾਈ ਜਾਂਦੀ ਹੈ ਜਿਸ ਦੇ ਵਿੱਚ ਕਿ ਝੋਨਾ ਅਤੇ ਕਣਕ ਬ ਬਹੁਤ ਮਸ਼ਹੂਰ ਹੈ ਇੱਥੇ ਦਾ ਇੱਥੇ ਦਾ ਪਾਣੀ ਵੀ ਬਹੁਤ ਵਧੀਆ ਮੰਨਿਆ ਗਿਆ ਹੈ ਪਰ ਹਾਲਾਂਕਿ ਹੁਣ ਗਰਾਊਂਡ ਵਾਟਰ ਲੈਵਲ ਡਿੱਗਦਾ ਜਾ ਰਿਹਾ ਹੈ ਧੰਨਵਾਦ